ਭਾਰਤੀ ਸਮਾਜ ਵਿੱਚ ਧਰਮ ਦੀ ਬਹੁਤ ਹੀ ਅਹਿਮ ਅਤੇ ਮਹੱਤਵਪੂਰਨ ਭੂਮਿਕਾ ਹੈ ਮੈਂ ਹਿੰਦੂ ਹਿੰਦੂ ਧਰਮ ਨੂੰ ਧਰਮ ਨੂੰ ਬਿਲੌਂਗ ਕਰਦੀ ਹਾਂ ਅਤੇ ਮੈਨੂੰ ਆਪਣਾ ਧਰਮ ਬਹੁਤ ਹੀ ਪਸੰਦ ਹੈ ਇਸ ਲਈ ਮੈਂ ਕਹਿਣਾ ਚਾਹੁੰਦੀ ਹਾਂ ਕਿ ਸਾਨੂੰ ਸਾਰਿਆਂ ਨੂੰ ਇੱਕ ਜੁੱਟ ਹੋ ਕੇ ਰਲ਼ ਮਿਲ ਕੇ ਅਤੇ ਸਹਿਯੋਗ ਨਾਲ਼ ਇਕੱਠੇ ਰਹਿਣਾ ਚਾਹੀਦਾ ਹੈ ਸਾਨੂੰ ਕਿਸੇ ਵੀ ਧਰਮ ਦੇ ਪ੍ਰਤੀ ਕੋਈ ਵੀ ਨਫ਼ਰਤ ਭੇਦਭਾਵ ਨਹੀਂ ਕਰਨੀ ਚਾਹੀਦੀ ਸਗੋਂ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਅਨੇਕਤਾ ਮੁਕਾ ਕੇ ਏਕਤਾ ਕਾਇਮ ਕਰਨੀ ਚਾਹੀਦੀ ਹੈ ਤਾਂ ਜੋ ਸਾਡਾ ਧਰਮ ਸਥਾਈ ਤੌਰ 'ਤੇ ਬਿਨਾਂ ਕਿਸੇ ਭੇਦਭਾਵ ਤੋਂ ਅਤੇ ਵਿਤਕਰੇ ਤੋਂ ਰਹਿਤ ਰਹ ਚੱਲਦਾ ਰਹੇ ਇਸ ਲਈ ਮੈਂ ਇੱਕ ਨਾਗਰਿਕ ਹੋਣ ਵਜ ਹੋਣ ਵੱਜੋਂ ਇਹ ਬੋਲਣਾ ਚਾਹੁੰਦੀ ਹਾਂ ਕਿ ਸਾਨੂੰ ਸਾਰੇ ਭੇਦਭਾਵ ਖ਼ਤਮ ਕਰਕੇ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ